ਹੈਲੋ ਮੈਂ ਗੁਰਦਾਸਪੁਰ ਤੋਂ ਜਗਦੀਸ਼ ਕੁਮਾਰੀ ਬੋਲ ਰਹੀ ਹਾਂ ਚੌਵੀ ਜਨਵਰੀ ਦੋ ਹਜ਼ਾਰ ਪੰਜ ਛੱਬੀ ਮਾਰਚ ਦੋ ਹਜ਼ਾਰ ਵੀਹ ਦਸ ਅਪ੍ਰੈਲ ਦੋ ਹਜ਼ਾਰ ਦਸ ਪੱਚੀ ਫਰਵਰੀ ਦੋ ਹਜ਼ਾਰ ਸਤਾਰਾਂ ਪੰਦਰਾਂ ਅਗਸਤ ਜੋ ਦੋ ਹਜ਼ਾਰ ਤੇਈ